ਹਾਂ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਪੰਜਾਬ 'ਚ ਇੰਡੀਆ 'ਚ ਬਹੁਤ ਸਾਰੇ ਮੌਸਮ ਹੁੰਦੇ ਜਿੱਦਾਂ ਗਰਮੀਆਂ ਹੋ ਗਈਆਂ ਸਰਦੀਆਂ ਹੋ ਗਈਆਂ ਪੱਤਝੜ ਹੋ ਗਈ ਪਰ ਮੈਨੂੰ ਸਭ ਤੋਂ ਵਧੀਆ ਲੱਗਦੀ ਆ ਕਿ ਜਿੱਦਾਂ ਸਰਦੀਆਂ ਸ਼ੁਰੂ ਹੁੰਦੀਆਂ ਵਾ ਅਤੇ ਜਿਹੜੀਆਂ ਆਪਣੀਆਂ ਸਰਦੀਆਂ ਹੁੰਦੀਆਂ ਵਾ ਉਹ 'ਚ ਮੈਂ ਸਟਾਰਟਿੰਗ 'ਚ ਹੀ ਹੁਣ ਪਿੱਛੇ ਜਿਹੇ ਜਦੋਂ ਐਤਕੀ ਸਾਲ ਸਰਦੀਆਂ ਸ਼ੁਰੂ ਹੋਈਆਂ ਸੀ ਮੈਂ ਤਾਂ ਜੈਪੁਰ ਗਿਆ ਹਾਂ ਮੈਂ ਅਤੇ ਮੇਰਾ ਫਰੈਂਡ ਅਸੀਂ ਦੋਵੇਂ ਬਹੁਤ ਇੰਜੋਏ ਕੀਤਾ ਉੱਥੇ ਅਸੀਂ ਉੱਥੇ ਬਹੁਤ ਸਾਰੀਆਂ ਜਗ੍ਹਾ ਘੁੰਮੇ ਕਿਉਂਕਿ ਨਾ ਉਦੋਂ ਜ਼ਿਆਦਾ ਗਰਮੀ ਸੀ ਨਾ ਉਦੋਂ ਜ਼ਿਆਦਾ ਠੰਡ ਸੀ ਅਤੇ ਆਪਾਂ ਮ ਉੱਥੇ ਜੰਤਰ ਮੰਤਰ ਜੰਤਰ ਮੰਤਰ 'ਚ ਵੀ ਗਏ ਹਾਂ ਉੱਥੇ ਤੁਹਾਨੂੰ ਪਤਾ ਕਿ ਰਾਜਸਥਾਨ 'ਚ ਬਹੁਤ ਜ਼ਿਆਦਾ ਉਹ ਆ ਕਿਲੇ ਜਿਹੇ ਆ ਕਿਲਿਆਂ 'ਚੋਂ ਅਸੀਂ ਬਹੁਤ ਘੁੰਮੇ ਹਾਂਂ ਕਿਉਂਕਿ ਉੱਥੇ ਤੁਹਾਨੂੰ ਪਤਾ ਕਿ ਆਪਣੀ ਕਿਹੜੇ ਹੁੰਦੇ ਆ ਕ ਜ਼ਿਆਦਾ ਉੱਧਰਲੀ ਸਾਈਡ ਮਹਾਰਾਜੇ ਰਹਿੰਦੇ ਰਹੇ ਆ ਅਤੇ ਫੇਰ ਅਸੀਂ ਜੰਤਰ ਮੌਸਮ ਇਸ ਤਾਂ ਪਸੰਦ ਆ ਕਿ ਮੌਸਮ 'ਚ ਆਪਾਂ ਇੰਜੋਏ ਕਰ ਸਕਦੇ ਹਾਂ ਗਰਮੀਆਂ ਹੋਣ 'ਤੇ ਤੁਹਾਨੂੰ ਪਤਾ ਗਰਮੀਆਂ 'ਚ ਵੀ ਬੰਦਾ ਪਸੀਨੇ ਨਾਲ ਭਿੱਜ ਜਾਂਦਾ ਅਤੇ ਸਰਦੀਆਂ ਹੋਣ 'ਤੇ ਠੰਡ 'ਚ ਉੱਦਾਂ ਨਹੀਂ ਘਰੋਂ ਨਿਕਲਣ ਦਾ ਜੀਅ ਕਰਦਾ ਹੁਣ ਜ਼ਿਆਦਾ ਠੰਡ ਆ ਅਤੇ ਮੈਂ ਤਾਂ ਆਪ ਨਹੀਂ ਰਜਾਈ 'ਚੋ ਨਿਕਲਦਾ ਅਤੇ ਹੁਣ ਤੁਹਾਡੇ ਨਾਲ ਗੱਲ ਕਰਨ ਡਿਆ ਅਤੇ ਉਹ ਵੀ ਮੈਂ ਰਜਾਈ 'ਚ ਪੈ ਕੇ ਕੀਤੀ ਆ ਅਤੇ ਤਾਂ ਕਰਕੇ ਮੈਨੂੰ ਚੜ੍ਹਦੀਆਂ ਸਰਦੀਆਂ ਬਹੁਤ ਵਧੀਆ ਲੱਗਦੀਆਂ ਵਾ ਅਤੇ ਜਿਹੜੀਆਂ ਸਰਦੀਆਂ ਹੁੰਦੀਆਂ ਵਾ ਅਤੇ ਉਨ੍ਹਾਂ 'ਚ ਆਪਾਂ ਇੰਜੋਏ ਵੀ ਕਰ ਸਕਦੇ ਹਾਂ ਘਰਦਿਆਂ ਨਾਲ ਥੋੜ੍ਹਾ ਬਹੁਤਾ ਟਾਈਮ ਵੀ ਸਪੈਂਡ ਕਰ ਸਕਦੇ ਹਾਂ ਦਿਨ ਵੀ ਛੋਟੇ ਹੁੰਦੇ ਆ ਉਹਨਾਂ 'ਚ ਆਪਾਂ ਸਰਦੀਆਂ 'ਚ ਆਪਾਂ ਘੁੰਮਣ ਜਾਈਏ ਕਿਤੇ ਅਤੇ ਆਪਾਂ ਸਟਾਰਟਿੰਗ ਸਰਦੀਆਂ ਜਾਂ ਏਂ ਲਾਸਟ ਸਰਦੀ 'ਚ ਜਾਈਏ ਅਤੇ ਕਈ ਕੁਛ ਆਪਾਂ ਕੱਪੜੇ ਵੀ ਪਾਈਦੇ ਆ ਸੋਹਣੇ ਸੋਹਣੇ ਹੈ ਨਾ ਅਤੇ ਜੈਕੀਟ ਹੋ ਗਈ ਕਿੱਦਾਂ ਪਜਾਮੇ ਹੋ ਗਏ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਫੈਸਨ ਆ ਫੈਸ਼ਨ ਦੇ ਨਾਲ ਆਪਾਂ ਸਰਦੀਆਂ 'ਚ ਬਹੁਤ ਵਧੀਆ ਵਧੀਆ ਕੱਪੜੇ ਪਾ ਸਕਦੇ ਹਾਂ ਅਤੇ ਆਪਣਾ ਕੀ ਨਾਂ ਲੈਂਦੇ ਆ ਜੈਪੁਰ ਜਾ ਕੇ ਮੈਂ ਬਹੁਤ ਸਰਦੀਆਂ ਸਟਾਰਟਿੰਗ ਸਰਦੀਆਂ 'ਚ ਗਿਆ ਦਿਨੇ ਉਥੇ ਧੁੱਪ ਹੁੰਦੀ ਸੀ ਅਤੇ ਛੇ ਕੁ ਵਜੇ ਤੋਂ ਬਾਅਦ 'ਚ ਉੱਥੇ ਥੋੜ੍ਹੀ ਥੋੜ੍ਹੀ ਠ ਠੰਡ ਹੋਣ ਲੱਗ ਪੈਂਦੀ ਅਤੇ ਅਸੀਂ ਆਪਣਾ ਬਹੁਤ ਇੰਨਜੋਮੈਂਟ ਕੀਤੀ ਉੱਥੇ ਬਸ